ਮੈਂ ਬਹੁਤ ਸਾਰੀ ਆਨਲਾਈਨ ਸ਼ਾਪਿੰਗ ਕਰਦੀ ਹਾਂ ਕਿ ਮੈਂ ਇੱਕ ਤਿੰਨ ਚੀਜ਼ਾਂ ਆਨਲਾਈਨ ਮੰਗਵਾਈਆਂ ਸੀ ਜਿਨਾਂ ਵਿੱਚੋਂ ਇੱਕ ਕਿਚਨ ਦਾ ਸਮਾਨ ਸੀ ਇੱਕ ਮੇਰੀ ਬੁਕਸ ਅਤੇ ਇੱਕ ਮੈਂ ਹੈਡਫੋਨ ਮੰਗਵਾਏ ਸੀ ਜਦੋਂ ਮੈਂ ਹੈਡਫੋਨ ਨੂੰ ਨੂੰ ਓਪਨ ਕੀਤਾ ਉਦੋਂ ਉਸਦਾ ਬੋਕਸ ਪਹਿਲਾਂ ਫਟਿਆ ਹੋਇਆ ਸੀ ਫਿਰ ਮੈਂ ਹੈਡਫੋਨ ਨੂੰ ਫੋਨ ਨਾਲ ਕਨੈਕਟ ਕਰਕੇ ਯੂਸ ਕੀਤੇ ਉਦੋਂ ਇੱਕ ਹੈਡਫੋਨ 'ਚ ਆਵਾਜ਼ ਸਹੀ ਆ ਰਹੀ ਸ ਆ ਰਹੀ ਸੀ ਅਤੇ ਦੂਸਰੇ ਵਿੱਚ ਨਹੀਂ ਆ ਰਹੀ ਸੀ